ਕੀ ਤੁਸੀਂ ਕਦੇ ਵਿਗਿਆਨ ਜਾਂ ਗਣਿਤ ਬਾਰੇ ਹੋਰ ਜਾਨਣ ਲਈ ਸਟਾਰਗੇਜਿੰਗ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਮੈਂ ਸਟਾਰਗੇਜਿੰਗ ਦੀ ਵਰਤੋਂ ਤਾਂ ਨਹੀਂ ਕਦੇ ਕੀਤੀ ਪਰ ਮੈਂ ਤੁਹਾਨੂੰ ਵਿਗਿਆਨ ਬਾਰੇ ਦੱਸਦਾ ਹਾਂ ਵਿਗਿਆਨ ਜਾਂ ਸਾਇੰਸ ਇੱਕ ਅਜਿਹਾ ਸੀਲੀ ਸੀਲੇਬਰ ਸਿਧਾਂਤਕ ਉਪਰਾਲਾ ਹੈ ਜਿਹੜਾ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਨੂੰ ਪਰਖ ਯੋਗ ਵਿਦਿਆਰ ਵਿਖਿਆਵਾਂ ਅਤੇ ਭਵਿੱਖਵਾਣੀਆਂ ਦੇ ਰੂਪ ਵਿੱਚ ਉਸਾਰਦੀ ਅਤੇ ਇਕੱਠੀ ਕਰਦੀ ਹੈ ਇੱਕ ਪੁਰਾਣੇ ਅਤੇ ਮਿਲਦੇ ਜੁਲਦੇ ਭਾਵ ਵਿੱਚ ਵਿਗਿਆਨ ਉਸ ਭਰੋਸੇ ਯੋਗ ਜਾਣਕਾਰੀ ਦੇ ਪੁੰਜ ਨੂੰ ਕਿਹਾ ਜਾਂਦਾ ਹੈ ਜਿਹੜੀ ਕਿ ਤਰਕਸ਼ੀਲ ਅਤੇ ਵਿਰ ਚਾਰਜਸ਼ੀਲ ਹੋਵੇ ਆਧੁਨਿਕ ਯੁੱਗ ਦੇ ਆਰੰਭ ਵਿੱਚ ਗਿਆਨ ਅਤੇ ਦਾਰਸ਼ਨਿਕ ਸਿਧਾਂਤ ਬਦਲਣ ਯੋਗ ਸ਼ਬਦ ਮੰਨੇ ਜਾਂਦੇ ਹਨ ਸਤਾਰਵੀਂ ਸਦੀ ਤੱਕ ਕੁਦਰਤੀ ਫਿਲਾਸਫੀ ਨੂੰ ਦਾਰਸ਼ਨਿਕ ਸਿਧਾਂਤ ਦੀ ਇੱਕ ਅੱਡ ਸ਼ਾਖਾ ਗਿਣਿਆ ਜਾਣ ਲੱਗਿਆ ਫਿਰ ਵੀ ਵਿਗਿਆਨ ਅਤੇ ਮੌਕਲੀਆਂ ਪਰਿਭਾਸ਼ਾਵਾਂ ਦੇਣਾ ਜਾਰੀ ਰਿਹਾ ਜਿਸ ਵਿੱਚ ਇਸ ਦਾ ਅਰਥ ਕਿਸੇ ਵਿਸ਼ੇ ਬਾਰੇ ਭਰੋਸੇਯੋਗ ਜਾਣਕਾਰੀ ਮੰਨਿਆ ਜਾਂਦਾ ਹੈ ਜਿਵੇਂ ਕਿ ਅੱਜ ਕੱਲ੍ਹ ਵਰਤੇ ਜਾਂਦੇ ਸ਼ਬਦਾਂ ਲਾਈਬ੍ਰੇਰੀ ਵਿਗਿਆਨ ਜਾਂ ਸਿਆਸੀ ਵਿਗਿਆਨ ਵਿੱਚ ਹੈ ਹੁਣ ਮੈਂ ਤੁਹਾਨੂੰ ਗਣਿਤ ਬਾਰੇ ਡਿਟੇਲ ਦੇਵਾਂਗਾ ਗਣਿਤ ਜਾਂ ਹਿਸਾਬ ਜਿੱਦਾਂ ਅੰਗਰੇਜ਼ੀ ਮਾਤਰਾ ਸੰਰਚਨਾ ਸਥਾਨ ਅਤੇ ਪਰਿਵਰਤਨ ਵਰਗੇ ਵਿਸ਼ਿਆਂ ਦਾ ਅਮੂਰਤ ਅਧਿਐਨ ਹੁੰਦਾ ਹੈ ਹਿਸਾਬ ਦਾਨਾ ਅਤੇ ਦਾਰਸੀ ਨਿੱਕਾ ਦਾ ਵਿੱਚ ਹਿਸਾਬ ਦੀ ਪਰਿਭਾਸ਼ਾ ਅਤੇ ਵਿਸ਼ਾ ਖੇਤਰ ਬਾਰੇ ਬਹਿਸ ਦਾ ਖੇਤਰ ਬੜਾ ਵੱਡਾ ਹੈ ਇਹ ਅਮੂਰਤ ਜਾਂ ਨਿਰਾਕਾਰ ਅਤੇ ਨਿਗੰਮੀ ਨੀ ਪ੍ਰਣਾਲੀ ਹੈ ਇਸ ਵਿੱਚ ਮਾਤਰਾਵਾਂ ਪਰੀਨਾਵਾਂ ਪ੍ਰੀਮਾਣਾ ਅਤੇ ਰੂਪਾਂ ਦੇ ਆਪਸੀ ਰਿਸ਼ਤੇ ਗੁਣ ਸੁਭਾਅ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ ਗਣਿਤ ਦੀਆਂ ਕਈ ਸ਼ਾਖਾਵਾਂ ਹਨ ਅੰਕ ਗਣਿਤ ਬੀਜ ਗਣਿਤ ਅੰਕੜਾ ਵਿਗਿਆਨ ਰੇਖਾ ਗਣਿਤ ਤਿਕੌਣ ਮਿਤੀ ਅਤੇ ਕਲਨ ਵਿੱਚ ਨਿਪੁੰਨ ਵਿਅਕਤੀ ਜਾਂ ਖੋਜ ਕਰਨ ਵਾਲੇ ਵਿਗਿਆਨੀਆਂ ਨੂੰ ਹਿਸਾਬ ਦਾਨ ਕਹਿੰਦੇ ਹਨ ਸ਼ੁਕਰੀਆ